ਹਾਂਜੀ ਮੈਂ ਪੰਜਾਬ ਤੋਂ ਬਾਹਰ ਨੂੰ ਘੁੰਮਦਾ ਤਾਂ ਰਹਿੰਦਾ ਵੈਸੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਅਤੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਨੇ ਜਿਹੜੀਆਂ ਉਹਨਾਂ ਵਿੱਚ ਲੋਕ ਵਿਤਕਰਾ ਤਾਂ ਕਰਦੇ ਹੀ ਨੇ ਆਪਣੇ ਪੰਜਾਬੀਆਂ ਨਾਲ ਮੈਂ ਪਿੱਛੇ ਜੇ ਆਪਣੇ ਉੱਤਰਾਖੰਡ 'ਚ ਘੁੰਮਣ ਗਿਆ ਸੀ ਅਤੇ ਉਹ ਮੇਰੇ ਪੱਗ ਬੰਨਣ ਪੱਗ ਬੰਨੀ ਹੋਈ ਕਰਕੇ ਅਤੇ ਮੈਨੂੰ ਪੱਗ ਬੰਨੀ ਹੋਈ ਕਰਕੇ ਨਾ ਆਪਣੇ ਹਿੰਦੀ ਭਾਸ਼ਾ ਆਉਂਦੀ ਨਹੀਂ ਸੀ ਪੰਜਾਬੀ ਭਾਸ਼ਾ ਆਉਂਦੀ ਸੀਗੀ ਉਥੋਂ ਦੇ ਲੋਕ ਬਹੁਤ ਵਿਤਕਰਾ ਕਰਦੇ ਸੀ ਮੈਂ ਨਾ ਉੱਥੇ ਦੇ ਲੋਕਾਂ ਨੂੰ ਕੁਝ ਕੁ ਲੋਕਾਂ ਨੂੰ ਪੁੱਛਿਆ ਦੇਹਰਾਦੂਨ ਜਾ ਕੇ ਕੀ ਮੈਂ ਰਿਸ਼ੀਕੇਸ਼ ਜਾਣਾ ਲਛਮਣ ਝੂਲੇ ਦੇ ਕੋਲ ਅਤੇ ਉਹਨਾਂ ਨੂੰ ਜੇ ਮੈਂ ਪੁੱਛਦਾ ਸੀ ਉਹ ਹੋਰੇ ਤਰ੍ਹਾਂ ਦਾ ਵਿਤਕਰਾ ਕਰਦੇ ਅਤੇ ਵੀ ਇਗਨੋਰ ਜਿਹਾ ਕਰਦੇ ਸੀਗੇ ਮਤਲਬ ਸਹੀ ਤਰ੍ਹਾਂ ਨਾਲ ਨਹੀਂ ਸੀ ਬੋਲਦੇ ਮੇਰੇ ਨਾਲ ਉਸ ਤੋਂ ਬਾਅਦ ਮੈਂ ਇੱਕ ਆਟੋ ਲਿੱਤਾ ਆਟੋ ਦੇ ਵਿੱਚ ਬੈਠਿਆ ਅਤੇ ਆਟੋ ਵਾਲਾ ਮੈਨੂੰ ਲੈ ਕੇ ਜਾ ਰਿਹਾ ਸੀ ਅਤੇ ਮੈਂ ਉਸਦੇ ਨਾਲ ਫਰੈਂਡਲੀ ਹੋਣ ਲਈ ਉਸ ਨਾਲ ਗੱਲ ਕਰਨ ਲੱਗ ਪਿਆ ਉਸ ਨੇ ਕੀ ਕੀਤਾ ਕਿ ਮੈਨੂੰ ਮੇਰੀਆਂ ਗੱਲਾਂ ਨੂੰ ਇਗਨੋਰ ਕਰਨ ਲੱਗ ਗਿਆ ਕਿਉਂਕਿ ਮੇਰੇ ਪੱਗ ਬੰਨੀ ਹੋਈ ਸੀ ਸਰਦਾਰ ਸੀ ਮੈਂ ਚਲੋ ਮੈਂ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਮੈਂ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਲੱਗਿਆ ਭੋਜਨ ਖਾਣ ਲੱਗਿਆ ਸੀਗਾ ਅਤੇ ਉਹਨਾਂ ਦਾ ਭੋਜਨ ਵੀ ਭੋਜਨ ਦੀ ਕੁਆਲਿਟੀ ਵੀ ਕੁਝ ਇੰਨੀ ਖਾਸ ਵਧੀਆ ਨਹੀਂ ਸੀ ਅਤੇ ਉਹਨਾਂ ਨੇ ਵੀ ਮੇਰੇ ਨਾਲ ਕੁਝ ਵਿਤਕਰਾ ਵਧੀਆ ਨਹੀਂ ਕੀਤਾ ਹੈਗਾ ਅਤੇ ਫਿਰ ਉਸ ਤੋਂ ਬਾਅਦ ਮੈਂ ਵਾਪਸ ਆ ਗਿਆ ਸੀ